ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਹਾਂ ਦੀਦੀ ਮੈਂ ਇੱਥੇ ਤੁਹਾਡੇ ਇੱਧਰ ਨਵੀਂ ਆਈ ਹੋਈ ਆ ਪੜੋਸੀ ਹਾਂ ਮੈਂ ਤੁਹਾਡੀ ਤਾਂ ਦੀਦੀ ਮੈਂ ਨਾ ਆਪਣੇ ਬੱਚਿਆਂ ਨੂੰ ਨਾ ਇੱਥੇ ਨਵੇਂ ਸਕੂਲ 'ਚ ਲਵਾਉਣਾ ਸੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਇੱਥੇ ਨਵਾਂ ਸ਼ਹਿਰ ਇਲਾਕੇ ਵਿੱਚ ਵਧੀਆ ਸਕੂਲ ਕਿਹੜੇ ਕਿਹੜੇ ਹਨ ਹਾਂਜੀ ਹਾਂਜੀ ਦੀਦੀ ਦੀਦੀ ਤੁਹਾਡੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਦੀਦੀ ਤੁੰ ਤੁਸੀਂ ਮੈਨੂੰ ਦੱਸ ਸਕਦੇ ਡੀ ਏ ਵੀ ਸਕੂਲ ਕਿੱਦਾਂ ਦਾ ਹੈਗਾ

ਹਾਂ ਅੱਛਾ ਦੀਦੀ ਅਤੇ ਮਤਲਬ ਕਿ ਇਹਨਾਂ ਦਾ ਰੋਜ਼ ਦਾ ਆਉਣਾ ਜਾਣਾ ਕਿਵੇਂ ਹੈ ਬੱਸਾਂ ਵਗੈਰਾ ਹੈਗੀਆਂ ਕਿ ਆਪਣੇ ਸਾਧਨ ਨਾਲੇ ਅੱਛਾ ਮਤਲਬ ਦੀਦੀ ਬੱਸਾਂ ਦੀਆਂ ਵੀ ਫੀਸ ਮਤਲਬ ਕਿ ਪਹਿਲੇ ਜਮ੍ਹਾਂ ਕਰਨੀਆਂ ਪੈਂਦੀਆਂ ਹੈ ਐਡਵਾਂਸ 'ਚ ਕਿ ਬਾਅਦ 'ਚ ਦੇਣੇ ਪੈਂਦੇ ਮੰਥਲੀ ਹਾਂਜੀ ਅਤੇ ਦੀਦੀ ਇੱਥੇ ਮਤਲਬ ਐਕਸਟਰਾ ਕਲਾਸਿਸ ਵਗੈਰਾ ਐਕਸਟਰਾਂ ਕਲਾਸਿਸ ਵਗੈਰਾ ਵੀ ਲੱਗਦੀਆਂ ਓਕੇ ਦੀਦੀ ਅਤੇ ਹੋਰ ਕੋਈ ਸਕੂਲਾਂ ਬਾਰੇ ਜੇ ਤੁਹਾਨੂੰ ਪਤਾ ਤਾਂ ਮੈਨੂੰ ਦੱਸਦੋ ਜੇ ਇਸ ਤੋਂ ਵਧੀਆ ਵੀ ਹੋਰ ਕੋਈ ਸਕੂਲ ਹੋਵੇ ਹਾਂਜੀ ਦੀਦੀ ਉਹ ਤਾਂ ਹੈ ਠੀਕ ਹੈ ਦੀਦੀ ਫਿਰ ਮੈਂ ਦੇਖਦੀ ਹਾਂ ਤੁਸੀਂ ਮੇਰੇ ਨਾਲ ਚੱਲੋਗੇ ਡੀ ਏ ਵੀ ਸਕੂਲ ਬੱਚਿਆਂ ਦਾ ਐਡਮਿਸ਼ਨ ਕਰਾਉਣ ਠੀਕ ਹੈ ਦੀਦੀ ਓਕੇ ਦੀਦੀ ਸਤਿ ਸ਼੍ਰੀ ਅਕਾਲ